ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਹਨ ਪਰ ਉਹਨਾਂ ਵਿੱਚੋਂ ਮੈਂ ਆਪਣੀ ਸਭ ਤੋਂ ਸੁੰਦਰ ਯਾਤਰਾ ਦਾ ਅਨੁਭਵ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇਹ ਯਾਤਰਾ ਮੈਂ ਦੋ ਹਜ਼ਾਰ ਉੱਨੀ ਵਿੱਚ ਕੀਤੀ ਸੀ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਵਿਸਾਖੀ ਦੇ ਮੇਲੇ 'ਤੇ ਮੱਥਾ ਟੇਕਣ ਗਈ ਸੀ ਇਸ ਦੌਰਾਨ ਅਸੀਂ ਰਾਹ ਦੇ ਵਿੱਚ ਬਹੁਤ ਸਾਰਾ ਜਗ੍ਹਾਵਾਂ 'ਤੇ ਘੁੰਮੇ ਅਤੇ ਬਹੁਤ ਸਾਰੀਆਂ ਸ਼ਹਿਰ ਆਦਿ ਦੇਖੇ ਬਹੁਤ ਸਾਰੇ ਹਾਈਵੇ ਆਦਿ ਦੇਖੇ ਜਿਸ ਤੋਂ ਬਾਅਦ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਅਸੀਂ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਅਤੇ ਉੱਥੇ ਬਣੇ ਹੋਏ ਅਜੂਬਾ ਅਜਾਇਬ ਘਰ ਵੀ ਗਏ ਉੱਥੇ ਜਾ ਕੇ ਅਸੀਂ ਬਹੁਤ ਸਾਰੀਆਂ ਤਸਵੀਰਾਂ ਵੀ ਖਿੱਚੀਆਂ ਬਹੁਤ ਸਾਰੀਆਂ ਮੈਮਰੀਜ਼ ਵੀ ਇਕੱਠੀਆਂ ਕੀਤੀਆਂ ਉਸ ਤੋਂ ਬਾਅਦ ਅਸੀਂ ਲੰਗਰ ਹਾਲ ਵਿੱਚ ਸੇਵਾ ਵੀ ਕਰਦੇ ਰਹੇ ਅਤੇ ਰਾਤ ਦੇ ਸਮੇਂ ਵਿੱਚ ਕੀਰਤਨ ਸਾਹਿਬ ਵੀ ਸੁਣਿਆ ਉਸ ਤੋਂ ਇਲਾਵਾ ਅਸੀਂ ਉਹ ਲਾਗੇ ਬਣੇ ਹੋਏ ਨੈਣਾ ਦੇਵੀ ਮੰਦਰ ਵੀ ਗਏ ਅਤੇ ਆਉਂਦੇ ਟਾਈਮ ਅਸੀਂ ਪਹਾੜੀ ਉੱਤੇ ਬਾਂਦਰਾ ਅਤੇ ਹੋਰ ਜਾਨਵਰਾਂ ਨੂੰ ਵੀ ਦੇਖਿਆ ਇਸ ਤੋਂ ਇਲਾਵਾ ਮੈਂ ਪਹਾੜੀ ਦੇ ਉਸ ਇਲਾਕੇ ਵਿੱਚ ਪਹਾੜੀਆਂ ਹੋਣ ਕਾਰਨ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦਾ ਅਦ ਦ੍ਰਿਸ਼ ਵੀ ਵੇਖਿਆ ਜੋ ਕਿ ਬਹੁਤ ਸੁੰਦਰ ਸੀ ਸ਼ਾਮ ਦਾ ਟਾਈਮ ਵਿੱਚ ਸੂਰਜ ਡੁੱਬਣ ਦਾ ਦ੍ਰਿਸ਼ ਬਹੁਤ ਹੀ ਵਧੀਆ ਸੀ ਸੂਰਜ ਡੁੱਬਦੇ ਸੈਮ ਐਨ ਲਾਲ ਸੀ ਅਤੇ ਬਹੁਤ ਹੀ ਲਾਲੀ ਮਾਰ ਰਿਹਾ ਸੀ ਅਤੇ ਸੂਰਜ ਚੜ੍ਹਦਾ ਵੀ ਬਹੁਤ ਸੋਹਣਾ ਲੱਗ ਰਿਹਾ ਸੀ ਠੰਡੀ ਠੰਡੀ ਹਵਾ ਸੀ ਅਤੇ ਠੰਡਾ ਜਿਹਾ ਮੌਸਮ ਸੀ ਇੱਕ ਬਹੁਤ ਹੀ ਆਨੰਦਮਈ ਮਾਹੌਲ ਸੀ ਜੀਅ ਕਰਦਾ ਸੀ ਕਿ ਮੈਂ ਆਪਣਾ ਸਾਰੀ ਜ਼ਿੰਦਗੀ ਉੱਥੇ ਬਿਤਾ ਦੇਵਾਂ ਬਹੁਤ ਹੀ ਵਧੀਆ ਮਾਹੌਲ ਸੀ